ਸਤਿ ਸ਼੍ਰੀ ਅਕਾਲ ਜੀ ਪੰਜਾਬ ਵਿੱਚ ਸਿਹਤ ਪ੍ਰਣਾਲੀ ਫੰਡ ਦਿੱਤਾ ਜਾਂਦਾ ਹੈ ਜਿਵੇਂ ਕੀ ਆਪਾਂ ਨੂੰ ਬਾਹਰਲੇ ਐਨ ਆਰ ਆਈ ਵੀ ਫੰਡ ਭੇਜਦੇ ਨੇ ਉਹਨਾਂ ਨਾਲ ਆਪਾਂ ਨੂੰ ਫੰਡ ਦਿੱਤਾ ਜਾਂਦਾ ਹੈ ਤੇ ਮਤਲਬ ਕੀ ਅੱਪਾ ਸਮਝਦੇ ਹਾਂ ਅੱਪਾ ਨੂੰ ਜਿਵੇਂ ਕੀ ਆਪਣਾ ਬੀਮਾ ਕੀਤਾ ਜਾਂਦਾ ਹੈ ਐਲ ਆਈ ਸੀ ਬੀਮਾ ਕੀਤਾ ਜਾਂਦਾ ਹੈ ਉਹ ਬੀਮੇ ਨਾਲ ਅੱਪਾ ਆਪਣੀ ਆਪਣੀ ਸਿਹਤ ਦੀ ਮਤਲਬ ਕਿ ਸਾਰੀ ਉਮਰ ਵਾਸਤੇ ਹੀ ਆਪਣਾ ਫੰਡ ਜਮਾ ਕਰ ਸਕਦੇ ਆਂ ਐਲ ਆਈ ਸੀ ਬੀਮੇ ਕਰਕੇ ਤੇ ਫਿਰ ਆਪਾਂ ਨੂੰ ਕੋਈ ਬਾਅਦ ਵਿੱਚ ਕੋਈ ਉਹ ਮਿਲਦੇ ਨੇ ਮਤਲਬ ਪੰਜਾਬ 'ਚ ਬਹੁਤ ਤਰ੍ਹਾਂ ਦੇ ਬੀਮੇ ਵੀ ਹੋ ਜਾਂਦੇ ਨੇ ਪਰ ਸਰਕਾਰੀ ਦੇਖਭਾਲਾਂ ਬਹੁਤ ਔਖੀਆਂ ਹੁੰਦੀਆਂ ਹਨ